ਹਾਂਜੀ ਠੀਕ ਆ ਦੀਦੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਦੀਦੀ ਠੀਕ ਨੇ ਆਪਣੇ ਤਾਂ ਤੁਸੀਂ ਸੁਣਾਓ ਘਰੇ ਸਾਰੇ ਠੀਕ ਨੇ ਹਾਂਜੀ ਦੱਸੋ ਦੀਦੀ ਹਾਂਜੀ ਹਾਂਜੀ ਹਾਂ ਦੀਦੀ ਪਵਾ ਲੈਂਦੇ ਹਾਂ ਹਾਂਜੀ ਹਾਂਜੀ ਹੁਣ ਐਂਉਂ ਆ ਦੀਦੀ ਹੈ ਨਾ ਕਮੇਟੀ ਵਾਲਿਆਂ ਨੂੰ ਆਪਾਂ ਨੇ ਕਿੰਨੇ ਵਾਰੀ ਕਹਿ ਤਾ ਹੈ ਨਾ ਉਹ ਤਾਂ ਕੋਈ ਫਿਰ ਆਪਾਂ ਨੂੰ ਦਿੰਦੇ ਹੈਗੇ ਹਾਂ ਆਪਾਂ ਨੂੰ ਹੀ ਕਰਨਾ ਪੈਂਦਾ ਹਾਂ ਹਾਂ ਹਾਂਜੀ ਹਾਂ ਹਾਂ ਹਾਂ ਹਾਂ ਐਂਏ ਨਾ ਮੀਂਹ ਵਗੈਰਾ ਪੈ ਜਾਂਦਾ ਚਿੱਕੜ ਹੋ ਜਾਂਦਾ ਫਿਰ ਆਪਾਂ ਨੂੰ ਇਹ ਔਖਾ ਹੋ ਜਾਂਦਾ ਹੈਗਾ ਹਾਂ ਇਹ ਤਾਂ ਹੁਣ ਕਰਨਾ ਹੀ ਪੈਣਾ ਹੈਗਾ ਰਾਤ ਬਰਾਤੇ ਕਈ ਵਾਰੀ ਕੋਈ ਨਹੀਂ ਟੋਏ ਦਾ ਪਤਾ ਲੱਗਦਾ ਹੈਗਾ ਕੋਈ ਗਿਰ ਗੁਰ ਜਾਵੇ ਕੋਈ ਬੱਚਾ ਗਿਰਜੇ ਸੱਟ ਵੱਜ ਜਾਂਦੀ ਆ ਹਾਂ ਹਾਂਜੀ ਹਾਂ ਕਰ ਲਾਂਗੇ ਦੇਖ ਲਾਂਗੇ ਫਿਰ ਆਪਾਂ ਬਾਕੀ ਗਲੀ ਦੇ ਨਾਲ ਵੀ ਪੁੱਛ ਲਾਂਗੇ ਜੇ ਕੋਈ ਪੈਸੇ ਦੇਣਾ ਚਾਹੂਗਾ ਨਹੀਂ ਤਾਂ ਫਿਰ ਆਪਾਂ ਦੋਏ ਘਰ ਤਾਂ ਕਰਾਂਗੇ ਹੀ ਹੈ ਨਾ ਹਾਂ ਹਾਂ ਹਾਂ ਕਿਉਂਕਿ ਫਿਰ ਆਏ ਆ ਨਾ ਜਦੋਂ ਹੁਣ ਆਪਾਂ ਨੂੰ ਇਹ ਔਖਾ ਹੋ ਜਾਂਦਾ ਹੈਗਾ ਕੋਈ ਵੀਹਕਲ ਵਗੈਰਾ ਅੰਦਰ ਕਰਨਾ ਪਰਾ ਟੋਆ ਹੁੰਦਾ ਮਸਾਂ ਹੀ ਅੰਦਰ ਵਾੜਿਆ ਜਾਂਦਾ ਫਿਰ ਮੋਟਰ ਮੋਟਰਸਾਈਕਲ ਵਗੈਰਾ ਹਾਂ ਹਾਂ ਹਾਂ ਕੋਈ ਹਾਂਜੀ ਹਾਂ ਔਖਾ ਤਾਂ ਹੋ ਹੀ ਜਾਂਦਾ ਹਾਂਜੀ ਹਾਂ ਹਾਂ ਹੋਰ ਹਾਂ ਔਖਾ ਤਾਂ ਹੋਈ ਜਾਂਦਾ ਹਾਂ ਹੁਣ ਫਿਰ ਆਪਾਂ ਦੇਖ ਕੇ ਸ਼ਾਮ ਨੂੰ ਕਰਦੇ ਹਾਂ ਸਾਰੇ ਜਣੇ ਸਲਾਹ ਵੀ ਕਿਵੇਂ ਬਣੂ ਹਾਂ ਬਈ ਕਿਵੇਂ ਕਿਹਨੂੰ ਕਹਿਣਾ ਵੀ ਟਰਾਲੀ ਟਰੁਲੀ ਵਾਲੇ ਨੂੰ ਵੀ ਪੁੱਛ ਲੈਣਗੇ ਹਾਂ ਸਾਰੇ ਜਾਣੇ ਰਾਇ ਕਰਕੇ ਵੀ ਭਈ ਕਿਵੇਂ ਪੈਸੇ ਪਾਉਣੇ ਆ ਕਿੰਨੇ ਕਿਥੋਂ ਮਿੱਟੀ ਲਿਆਉਣੀ ਆਂ ਹੈ ਨਾ ਸਾਰਾ ਕੁਝ ਹਾਂ ਹਾਂ ਹਾਂ

ਹਾਂਜੀ ਹਾਂ ਹਾਂ ਹਾਂ ਚਲੋ ਦੇਖਦੇ ਆ ਫਿਰ ਮਿਲਦੇ ਆ ਦੀਦੀ ਫਿਰ ਹੈਂ ਕਰਦੇ ਆ ਸਲਾਹ ਹਾਂ ਠੀਕ ਹੈ ਜੀ ਓਕੇ ਜੀ ਓਕੇ ਹਾਂਜੀ ਹਾਂ ਠੀਕ ਹੈ ਜੀ ਓਕੇ ਠੀਕ ਹੈ ਜੀ